ਜਦੋਂ ਅਸੀਂ ਛੋਟੇ ਛੋਟੇ ਹੁੰਦੇ ਤੇ ਤਦ ਬਲਦਾਂ ਨਾਲ ਖੇਤੀ ਹੁੰਦੀ ਤੀ ਪਰ ਜਿਵੇਂ ਜਿਵੇਂ ਸਮੇਂ ਗੁਜਰਿਆ ਇੱਥੇ ਟਰੈਕਟਰ ਆ ਗਏ ਕੰਬਾਈਨਾਂ ਆ ਗਈਆਂ ਹੋਰ ਮਸ਼ੀਨਾਂ ਆ ਜਿਹਦੇ ਨਾਲ ਕਿਸਾਨ ਆਪਣੀ ਖੇਤੀ ਕਰਨ ਲੱਗਾ ਆਸਾਨ ਹੋ ਗਿਆ ਖੇਤੀ ਕਰਨਾ ਅਤੇ ਖੇਤੀ ਕਰਨ ਨਾਲ ਅ ਬਲਦਾਂ ਦੀ ਬਹੁਤ ਘਾਟ ਹੋ ਗਈ ਹੈ ਬਹੁਤ ਘੱਟ ਯੂਜ਼ ਕਰਦੇ ਨੇ ਟਰੈਕਟਰ ਆਉਣ ਕਰਕੇ ਅਤੇ ਬਹੁਤ ਸ ਫੈਸਲਿਟੀ ਮਿਲ ਗਈ ਨੇ ਇਹ ਹੋਰ ਮਸ਼ੀਨ ਆਉਣ ਕਰਕੇ ਦਾਣੇ ਧਾਨ ਵੱਢਣ ਲਈ ਪਾਣੀ ਲਾਉਣ ਲਈ ਹਰੇਕ ਚੀਜ਼ ਦੀ ਮਸ਼ੀਨ ਆਈ ਹੋਈ ਹੈ